ਪੰਜਾਬ ਦਾ ਸੱਭਿਆਚਾਰ ਬਹੁਤ ਹੀ ਵਧੀਆ ਸੱਭਿਆਚਾਰ ਆ ਅਤੇ ਕਿਸੇ ਹੋਰ ਦੇਸ਼ਾਂ ਦੇ ਸੱਭਿਆਚਾਰ ਦੇ ਨਾਲ ਮੈਨੂੰ ਨਹੀਂ ਲੱਗਦਾ ਵੀ ਇਹਦਾ ਕੋਈ ਮੁਕਾਬਲਾ ਹੈ ਬਹੁਤ ਹੀ ਜ਼ਿਆਦਾ ਵਧੀਆ ਸੱਭਿਆਚਾਰ ਹੈ ਇੱਕ ਤਾਂ ਸੱਭਿਆਚਾਰ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਡੀਆਂ ਧਾਰਮਿਕ ਭਾਵਨਾਵਾਂ ਆ ਜਾਂਦੀਆਂ ਨੇ ਧਰਮ ਹਰ ਚੀਜ਼ ਜਿਹੜੀ ਹੈਗੀ ਹੈ ਉਹ ਧਰਮ ਦੇ ਨਾਲ ਜੁੜੀ ਹੋਈ ਹੈ ਚਾਡੇ ਤੁਹਾ ਤੁਹਾਡਾ ਉਹ ਵਿਆਹ ਦਾ ਫੰਕਸ਼ਨ ਹੈ ਭਾਵੇਂ ਭਾਵੇਂ ਤੁਹਾਡਾ ਕੋਈ ਹੋਰ ਫੰਕਸ਼ਨ ਹੈ ਭਾਵੇਂ ਤੁਹਾਡੇ ਕੋਈ ਸਕੂਲ ਦੇ ਵਿੱਚ ਕੋਲਜ ਦੇ ਵਿੱਚ ਕੋਈ ਹੈ ਪਹਿਲਾਂ ਇੱਕ ਧਾਰਮਿਕ ਸ਼ਬਦ ਦੇ ਨਾਲ ਹੀ ਹਮੇਸ਼ਾ ਸ਼ੁਰੂ ਹੁੰਦਾ ਹੈ ਆ ਜਿਹੜੀਆਂ ਰੱਬ ਦੀਆਂ ਬਲੈਸਿੰਗਜ਼ ਹੈ ਰੱਬ ਦੇ ਜਿਹੜਾ ਅਸ਼ੀਰਵਾਦ ਹੈ ਉਹ ਜ਼ਰੂਰ ਸਭ ਤੋਂ ਪਹਿਲਾਂ ਲਿਆ ਜਾਂਦਾ ਹੈ ਅਤੇ ਜਿਹੜਾ ਇਹ ਤੁਹਾਡੀ ਜਿਹੜੀ ਬ ਮਤਲਬ ਸਾਕਾਰਾਤਮਕ ਜਿਹੜੀਆਂ ਹੈਗੀਆਂ ਤਰੰਗਾਂ ਉਹ ਤੁਹਾਡੇ ਵਿੱਚ ਆ ਜਾਂਦੀਆਂ ਨੇ ਤੁਹਾਡੇ ਜਿਹੜੇ ਉਸ ਮਾਹੌਲ ਦੇ ਵਿੱਚ ਐਂਟਰ ਹੋ ਜਾਂਦੀਆਂ ਨੇ ਅਤੇ ਜਿਹੜਾ ਪੰਜਾਬ ਦੇ ਵਿੱਚ ਖਾਣਾ ਪੀਣਾ ਹੈ ਉਹ ਵੀ ਬਾਕੀ ਜਿਹੜੇ ਹੈਗੇ ਆ ਦੇਸ਼ਾਂ ਦੇ ਸੱਭਿਆਚਾਰ ਨਾਲੋਂ ਉਹ ਵੀ ਬਹੁਤ ਅਲੱਗ ਹੈ ਬਹੁਤ ਹੈਲਦੀ ਜਿਹੜਾ ਹੈਗਾ ਹੈ ਆ ਸਿਹਤਮੰਦ ਖਾਣਾ ਪੀਣਾ ਆ ਪੰਜਾਬ ਦਾ ਆਪ ਹਰ ਚੀਜ਼ ਬਣਾਈ ਜਾਂਦੀ ਹੈ ਘਰ ਦੇ ਵਿੱਚ ਹੀ ਬਣਾਈ ਜਾਂਦੀ ਹੈ ਅਤੇ ਆਪਣੇ ਹੱਥ ਨਾਲ ਰੋਟੀ ਬਣਾ ਕੇ ਖਾਣ ਨੂੰ ਹੀ ਸਭ ਤੋਂ ਵਧੀਆ ਸਮਝਿਆ ਜਾਂਦਾ ਹੈ ਜਿਵੇਂ ਬਾਕੀ ਦੇਸ਼ਾਂ ਦੇ ਵਿੱਚ ਕੀ ਹੁੰਦਾ ਕਿ ਬਾਕੀ ਦੇਸ਼ਾਂ ਦੇ ਵਿੱਚ ਜ਼ਿਆਦਾਤਰ ਲੋਕ ਰੈਡੀਮੇਡ ਚੀਜ਼ਾਂ ਲਿਆਉਂਦੇ ਨੇ ਅਤੇ ਉਹੀ ਖਾਂਦੇ ਨੇ ਬਟ ਪੰਜਾਬ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕੋਈ ਘਰ ਹੋਏਗਾ ਜਿੱਥੇ ਤਿੰਨੋਂ ਟਾਈਮ ਰੋਟੀ ਸਬਜ਼ੀ ਨਹੀਂ ਬਣਦੀ ਹੋਊਗੀ ਅਤੇ ਉਹੀ ਜਿਹੜੀ ਹੈ ਪੰਜਾਬੀਆਂ ਦੀ ਸਿਹਤ ਦਾ ਵੀ ਇਹੀ ਰਾਜ ਹੈ ਕਿ ਹੈਲਦੀ ਰੋਟੀ ਜਿਹੜੀ ਹੈਗੀ ਆ ਉਹ ਤਿੰਨੋਂ ਟਾਈਮ ਫਰੈਸ਼ ਰੋਟੀ ਬਣ ਕੇ ਤੁਹਾਨੂੰ ਮਿਲਦੀ ਆ ਅਤੇ ਪੰਜਾਬ ਦੇ ਵਿੱਚ ਜਿਹੜਾ ਪਹਿਨਣ ਦਾ ਕੱਪੜਿਆਂ ਦਾ ਪਹਿਰਾਵਾ ਹੈ ਉਹ ਵੀ ਬਹੁਤ ਵਧੀਆ ਹੈ ਉਹ ਵੀ ਧਰਮ ਦੇ ਨਾਲ ਹੀ ਰਿਲੇਟਡ ਹੈ ਅਤੇ ਅੱਜ ਕੱਲ੍ਹ ਉਹ ਹੈ ਕਿ ਪੰਜਾਬ ਦੇ ਵਿੱਚ ਥੋੜ੍ਹਾ ਜਿਹਾ ਵੈਸਟਰਨ ਇਫੈਕਟ ਆ ਗਿਆ ਹੈ ਬਟ ਫੇਰ ਵੀ ਜੇ ਆਪਾਂ ਦੇਖੀਏ ਕਿ ਪੰਜਾਬ ਦਾ ਜਿਹੜਾ ਪਹਿਰਾਵਾ ਹੈ ਉਹ ਆਪਣੇ ਆਪ ਦੇ ਵਿੱਚ ਸੰਪੂਰਨ ਹੈ ਉਹਨੂੰ ਕਿਸੇ ਹੋਰ ਚੀਜ਼ ਦੀ ਜ਼ਰੂਰਤ ਨਹੀਂ ਹੈ